ਮੇਰਾ ਨਾਮ ਮੋਨੀਕਾ ਹੈ ਮੈਂ ਸਰਕਾਰੀ ਸਕੂਲ ਵਿੱਚ ਜਦੋਂ ਪੜ੍ਹਦੀ ਸੀ ਅਤੇ ਸਾਡੇ ਸਕੂਲ ਵਿੱਚ ਇੱਕ ਕੋਚ ਸਰ ਸਨ ਜੋ ਕਿ ਸਾਨੂੰ ਹਰੇਕ ਪ੍ਰਕਾਰ ਦੀਆਂ ਖੇਡਾਂ ਸਿਖਾਉਂਦੇ ਸੀ ਉਹਨਾਂ ਦਾ ਨਾਮ ਸ਼ਿਵ ਸਰ ਹੈ ਉਹ ਸਾਨੂੰ ਜ਼ਿਆਦਾਤਰ ਕਬੱਡੀ ਸਿਖਾਉਂਦੇ ਸੀ ਉਸ ਨਾਲ ਸਾਨੂੰ ਦੱਸਦੇ ਸੀ ਕਿ ਕਬੱਡੀ ਨੂੰ ਮਾਂ ਖੇਡ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਕਬੱਡੀ ਸਾਰਿਆਂ ਦੀਆਂ ਸਾਰਿਆਂ ਦੀ ਹਰਮਨ ਪਿਆਰੀ ਖੇਡ ਹੈ ਉਹ ਸਾਨੂੰ ਹੋਰ ਵੀ ਖੇਡਾਂ ਬਾਰੇ ਵਧੀਆ ਵਧੀਆ ਗੱਲਾਂ ਦੱਸਦੇ ਸ ਰਹਿੰਦੇ ਹਨ ਅਤੇ ਉਹ ਕਬੱਡੀ ਦੇ ਨਾਲ ਨਾਲ ਹੋਰ ਵੀ ਕਈ ਪ੍ਰਕਾਰ ਦੀਆਂ ਖੇਡਾਂ ਖਲਾਉਂਦੇ ਸਨ ਜਿਵੇਂ ਕਿ ਖੋ ਖੋ ਹੋ ਗਈ ਗੈਲਰੀ ਹੋ ਗਈ ਹੋਰ ਵੀ ਦੌੜ ਵਗੈਰਾ ਹੋਰ ਵੀ ਕਈ ਪ੍ਰਕਾਰ ਦੀਆਂ ਸਾਨੂੰ ਖੇਡਾਂ ਖਿਡਾਉਂਦੇ ਸੀ ਪਰ ਜ ਉਹਦੇ ਵਿੱਚ ਜ਼ਿਆਦਾ ਸਾਨੂੰ ਕਬੱਡੀ ਹੀ ਸਿਖਾਉਂਦੇ ਸੀ ਅਤੇ ਕਹਿੰਦੇ ਹਨ ਕਿ ਕਬੱਡੀ ਨੂੰ ਪੰਜਾਬ ਦੀ ਸ਼ਾਨ ਵੀ ਕਿਹਾ ਜਾਂਦਾ ਹੈ ਉਹ ਸਾਨੂੰ ਕਬੱਡੀ ਬਾਰੇ ਬਹੁਤ ਹੀ ਵਧੀਆ ਵਧੀਆ ਗੱਲਾਂ ਦੱਸਦੇ ਸੀ ਉਹ ਸਾਨੂੰ ਦੱਸਦੇ ਇਹ ਵੀ ਦੱਸਦੇ ਹਨ ਕਿ ਕਬੱਡੀ ਖੇਡਣ ਨਾਲ ਸਾਡਾ ਸਰੀਰ ਤੰਦਰੁਸਤ ਵੀ ਰਹਿੰਦਾ ਹੈ ਜੋ ਕਿ ਸਾਡੇ ਅੰਦਰ ਚੁਸਤੀ ਲਿਆਉਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਹਮੇਸ਼ਾਂ ਪਿਆਰ ਨਾਲ ਖਲਾਉਂਦੇ ਸੀ ਉਹ ਸਾਨੂੰ ਹ ਸਮ ਹਮੇਸ਼ਾਂ ਸਿਖਾਉਂਦੇ ਸੀ ਕਿ ਸਾਨੂੰ ਕਬੱਡੀ ਹਮੇਸ਼ਾਂ ਇੱਕ ਦੂਜੇ ਨਾਲ ਪਿਆਰ ਨਾਲ ਹੀ ਖੇਡਣੀ ਚਾਹੀਦੀ ਹੈ ਉਹ ਸਾਨੂੰ ਇਸ ਤੋਂ ਇਲਾਵਾ ਵੀ ਹੋਰ ਬਹੁਤ ਬਹੁਤ ਵਧੀਆ ਵਧੀਆ ਗੱਲਾਂ ਦੱਸਦੇ ਸਨ